ਕਹਿੰਦੇ ਨੇ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਇੱਕ ਤੰਦਰੁਸਤ ਜਿਹੜਾ ਦਿਮਾਗ ਹੈ ਉਸ ਦਾ ਵਾਸਾ ਹੁੰਦਾ ਹੈ ਉਹ ਮਤਲਬ ਕਿ ਅਗਰ ਤੁਹਾਡਾ ਸਰੀਰ ਰਿਸ਼ਟ ਪੁਸ਼ਟ ਹੈ ਤਾਂ ਹੀ ਤੁਹਾਡਾ ਦਿਮਾਗ ਤੇਜ਼ ਚੱਲੇਗਾ ਤਾਂ ਅਗਰ ਅਸੀਂ ਇਸ ਚੀਜ਼ ਨੂੰ ਆਪਣੀ ਐਜੂਕੇਸ਼ਨ ਦੇ ਵਿੱਚ ਲੈ ਕੇ ਚੱਲੀਏ ਸਿੱਖਿਆ ਦੇ ਵਿੱਚ ਤਾਂ ਜਦੋਂ ਬੱਚਾ ਸਿੱਖਿਆ ਗ੍ਰਹਿਣ ਕਰਨ ਸਕੂਲ ਜਾਂ ਕੋਲਜ ਜਾਂਦਾ ਹੈ ਤਾਂ ਮੈਂ ਸਮਝਦੀ ਹਾਂ ਉਹਦੇ ਨਾਲ ਉਹਨਾਂ ਦੀਆਂ ਖੇਡਾਂ 'ਤੇ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ ਪਹਿਲਾ ਨੰਬਰ ਤਾਂ ਇਹੀ ਹੈ ਕਿ ਖੇਡਾਂ ਖੇਡਣ ਦੇ ਨਾਲ ਜਦੋਂ ਤੁਹਾਡਾ ਸਰੀਰ ਦੌੜ ਭੱਜ ਕਰ ਰਿਹਾ ਹੁੰਦਾ ਹੈ ਤਾਂ ਤੁਹਾਡਾ ਦਿਮਾਗ ਅਰਾਮ ਕਰ ਰਿਹਾ ਹੁੰਦਾ ਹੈ ਇਸ ਦੇ ਨਾਲ ਹੀ ਅਗਰ ਬੱਚਾ ਖੇਡਾਂ ਦੇ ਵਿੱਚ ਕੋਈ ਚੰਗੀ ਟਰਾਫੀ ਜਾਂ ਕ ਅੱਛੀ ਅਚੀਵਮੈਂਟ ਲੈ ਲੈ ਆਉਂਦਾ ਹੈ ਤਾਂ ਅੱਗੇ ਚੱਲ ਕੇ ਇਹ ਉਸਦੇ ਕਰੀਅਰ ਨੂੰ ਵੀ ਅੱਗੇ ਵਿਕਸਿਤ ਕਰਦੀ ਹੈ ਉਸਨੂੰ ਉਹ ਉਹ ਜਿਹੜੀ ਹੈ ਕਰੀਅਰ ਦੇ ਵਿੱਚ ਵੀ ਉਹ ਅੱਗੇ ਜਾ ਸਕਦਾ ਹੈ ਬੱਚਾ ਅਗਰ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਹੈ ਤਾਂ ਮੈਂ ਸਮਝਦੀ ਹਾਂ ਕਿ ਉਹ ਇਹੋ ਜਿਹੇ ਕੁਛ ਵਿਸ਼ੇ ਲੈ ਸਕਦਾ ਹੈ ਜਿਸਦੇ ਵਿੱਚ ਕਿ ਉਸਨੂੰ ਮੈਥ ਵਗੈਰਾ ਜਾਂ ਸਾਇੰਸ ਜਿਸਦੇ ਵਿੱਚ ਵੀ ਬੱਚੇ ਦੀ ਰੁਚੀ ਹੈ ਪਰ ਅਗਰ ਨਾਲ ਦੀ ਨਾਲ ਹੀ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਗਰ ਬੱਚਾ ਖੇਡਾਂ ਦੇ ਵਿੱਚ ਬਹੁਤ ਅੱਛਾ ਜਾ ਰਿਹਾ ਹੈ ਤਾਂ ਸਾਨੂੰ ਉਹਨੂੰ ਹਰ ਟਾਇਮ ਇਸ ਪ੍ਰੈਸ਼ਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿ ਉਹ ਅੱਛੀ ਪੜ੍ਹਾਈ ਦੇ ਵਿੱਚ ਵੀ ਪਰਫੋਮ ਕਰੇ ਮੈਂ ਇਹ ਨਹੀਂ ਕਹਿੰਦੀ ਕਿ ਉਹ ਪੜ੍ਹਾਈ ਦੇ ਵਿੱਚ ਪਰਫੋਮ ਨਾ ਕਰੇ ਮੈਂ ਇਹ ਕਹਿੰਦੀ ਹਾਂ ਕਿ ਉਹਦੀ ਪੜ੍ਹਾਈ ਦੇ ਉੱਪਰ ਵੀ ਧਿਆਨ ਦਿੱਤਾ ਦੇਣਾ ਚਾਹੀਦਾ ਹੈ ਪਰ ਸਾਨੂੰ ਬੱਚੇ ਦੀਆਂ ਸਕਿੱਲਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਰ ਉਹ ਖੇਡਾਂ ਦੇ ਵਿੱਚ ਜਾਂ ਫਿਜ਼ੀਕਲੀ ਜ਼ਿਆਦਾ ਅੱਛਾ ਪਰਫੋਮ ਕਰ ਰਿਹਾ ਹੈ ਤਾਂ ਸਾਨੂੰ ਉਹਨਾਂ ਦੀ ਉਸ ਪੱਖ ਵੱਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਜਿਸਦੇ ਵਿੱਚ ਕਿ ਉਹ ਅੱਛਾ ਪਰਫੋਮ ਕਰ ਰਿਹਾ ਹੈ ਅਤੇ ਉਹ ਅਸੀਂ ਸਾਨੂੰ ਉਸ ਬੱਚੇ ਨੂੰ ਉਸ ਪੱਖ ਦੇ ਜ਼ਿਆਦਾ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ ਇਸ ਦੇ ਨਾਲ ਹੀ ਅਸੀਂ ਇੱਕ ਅੱਛਾ ਪੜ੍ਹਿਆ ਲਿਖਿਆ ਸਮਾਜ ਅਤੇ ਤੰਦਰੁਸਤ ਸਮਾਜ ਵੀ ਵਿਕਸਿਤ ਕਰ ਸਕਦੇ ਹਾਂ ਅਗਰ ਇੱਕ ਬੱਚਾ ਬਹੁਤ ਪੜ੍ਹਾਈ ਦੇ ਵਿੱਚ ਵੀ ਅੱਛਾ ਹੈ ਤਾਂ ਉਸਨੂੰ ਦਿਨ ਦਾ ਕੁਛ ਸਮਾਂ ਖੇਡਣ ਦੇ ਵਿੱਚ ਜਾਂ ਫਿਜ਼ੀਕਲ ਐਕਟੀਵੀਜ਼ ਦੇ ਵਿੱਚ ਜ਼ਰੂਰ ਬਿਤਾਉਣਾ ਚਾਹੀਦਾ ਹੈ ਸਾਡੇ ਸਮਾਜ ਵਿੱਚ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੇ ਵਿੱਚ ਖੇਡਾਂ ਦੀ ਜਿਹੜੀ ਮਹੱਤਤਾ ਹੈ ਉਸਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਨੂੰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਉਹ ਤੰਦਰੁਸਤ ਚੁਸਤ ਦਿਮਾਗ ਹੋਣ ਅਗਰ ਤੁਸੀਂ ਫਿਜ਼ੀਕਲੀ ਐਕਟਿਵ ਹੋ ਤਾਂ ਤੁਸੀਂ ਬਾਕੀ ਚੀਜ਼ਾਂ ਦੇ ਵਿੱਚ ਵੀ ਅੱਛਾ ਪਰਫੋਮ ਕਰ ਸਕਦੇ ਹੋ